ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਦੇ ਬੱਚੇ ਆਪਣਾ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ ਤੁਹਾਨੂੰ ਇਸ ਦਾ ਮੁੱਖ ਕਾਰਨ ਪਤਾ ਕੀ ਹੈ ਇਸਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਵਿੱਚ ਰੁਜ਼ਗਾਰ ਤਾਂ ਹੈ ਪਰ ਇੱਥੇ ਘੱਟ ਬਹੁਤ ਕੰਪਨੀਆਂ ਵਾਲੇ ਬਹੁਤ ਘੱਟ ਪੈਸਾ ਦਿੰਦੇ ਹਨ ਤਾਂ ਕਰਕੇ ਲੋਕ ਆਪਣੇ ਬੱਚਿਆਂ ਨੂੰ ਬਾਰਵੀਂ ਤੋਂ ਬਾਅਦ ਆਇਲਸ ਕਰਵਾ ਕੇ ਬਾਹਰ ਭੇਜ ਦਿੰਦੇ ਹਨ ਕਿਉਂਕਿ ਉੱਥੇ ਬਹੁਤ ਹੀ ਜ਼ਿਆਦਾ ਪੈਸਾ ਹੈ ਠੀਕ ਹੈ ਦੂਜਾ ਕਾਰਨ ਇਹ ਹੈ ਕਿ ਪੰਜਾਬ ਅੱਜ ਕੱਲ੍ਹ ਨਸ਼ਿਆਂ ਵਿੱਚ ਬਹੁਤ ਹੀ ਜ਼ਿਆਦਾ ਜਾ ਰਿਹਾ ਹੈ ਅਤੇ ਕੋਈ ਵੀ ਮਾਂ ਪਿਓ ਇਹ ਨਹੀਂ ਚਾਹਵੇਗਾ ਕਿ ਉਸਦੇ ਬੱਚੇ ਨੂੰ ਨਸ਼ੇ ਦੀ ਲਤ ਲੱਗ ਜਾਵੇ ਤੁਸੀਂ ਅੱਜ ਕੱਲ੍ਹ ਦੇਖਦੇ ਹੀ ਹੋ ਕਿ ਕਦੇ ਕੋਈ ਮੁੰਡਾ ਕਿਸੇ ਝੀਲ 'ਤੇ ਡਿੱਗਿਆ ਪਿਆ ਹੁੰਦਾ ਹੈ ਨਸ਼ੇ ਕਰਕੇ ਅਤੇ ਕਿਸੇ ਦਾ ਮੁੰਡਾ ਮਰ ਜਾਂਦਾ ਹੈ ਨਸ਼ੇ ਦੇ ਟੀਕੇ ਲਗਾ ਕੇ ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮਾਂ ਪਿਓ ਇਹ ਚਾਹਵੇਗਾ ਕਿ ਉਸਦਾ ਬੱਚਾ ਨਸ਼ਾ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਦੇਵੇ ਤਾਂ ਕਰਕੇ ਮਾਂ ਪਿਓ ਡਰਦੇ ਹੋਏ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਦਿੰਦੇ ਹਨ ਤਾਂ ਕਿ ਉੱਥੇ ਉਹ ਵਧੀਆ ਸੈਟਲ ਹੋ ਜਾਣ ਪਰ ਗੱਲ ਇਹ ਹੈ ਕਿ ਸਾਰੇ ਬੱਚੇ ਬਾਹਰ ਜਾ ਰਹੇ ਹਨ ਆਪਣਾ ਪੰਜਾਬ ਖਾਲੀ ਹੋ ਰਿਹਾ ਹੈ ਠੀਕ ਹੈ ਪਿੱਛੇ ਮਾਂ ਪਿਓ ਇਕੱਲੇ ਰਹਿ ਜਾਂਦੇ ਹਨ ਕੱਲ੍ਹ ਨੂੰ ਕੋਈ ਉੱਨੀ ਇੱਕੀ ਗੱਲ ਹੋ ਜਾਵੇ ਮਾਂ ਪਿਓ ਨੂੰ ਤਾਂ ਬੱਚੇ ਨੂੰ ਆਉਂਦਿਆਂ ਬਹੁਤ ਹੀ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਉੱਥੇ ਮਾਂ ਪਿਓ ਇੱਕ ਬੱਚੇ ਦੀ ਉਡੀਕ ਵਿੱਚ ਰਹਿੰਦੇ ਹਨ ਮੇਰਾ ਬੱਚਾ ਅੱਜ ਆਵੇਗਾ ਮੇਰਾ ਬੱਚਾ ਕੱਲ੍ਹ ਆਵੇਗਾ ਠੀਕ ਪਰ ਕੀ ਕਹਿੰਦੇ ਆ ਉਹ ਆਪਣੇ ਮਾਂ ਪਿਓ ਦੇ ਸੰਸਕਾਰ 'ਤੇ ਵੀ ਨਹੀਂ ਪਹੁੰਚ ਪਾਉਂਦੇ ਜਦੋਂ ਉਹਨਾਂ ਨੂੰ ਆਖਰੀ ਠਾ ਟਾਈਮ 'ਤੇ ਆਪਣੇ ਬੱਚਿਆਂ ਦੀ ਸਾਰਿਆਂ ਨਾਲੋਂ ਵੱਧ ਲੋੜ ਹੁੰਦੀ ਹੈ ਤਾਂ ਕਰਕੇ ਮੇਰੀ ਤਾਂ ਇਹ ਹੀ ਉਹ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੀਏ ਅਤੇ ਉਹਨਾਂ ਨੂੰ ਵਧੀਆ ਪੜ੍ਹਾਈ ਦੇਈਏ ਅਤੇ ਉਹਨਾਂ ਨੂੰ ਸਿਖਾਈਏ ਕਿ ਤੁਸੀਂ ਇੱਥੇ ਨਸ਼ਿਆਂ ਨੂੰ ਨਸ਼ੇ ਦੀ ਲਤ ਨਾ ਲਗਾ ਕੇ ਆਪਣਾ ਕਾਰੋਬਾਰ ਇੱਥੇ ਹੀ ਸੈੱਟ ਕਰੋ ਤਾਂ ਕਿ ਤੁਸੀਂ ਆਪਣੇ ਮਾਂ ਪਿਓ ਦਾ ਵੀ ਧਿਆਨ ਰੱਖ ਸਕੋ ਅਤੇ ਵਧੀਆ ਪੈਸਾ ਕਮਾ ਸਕੋ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਹੀ ਸ ਸਬਕ ਸਿਖਾ ਪਾਓ ਕਿ ਬਾਹਰ ਕੁਛ ਵੀ ਨਹੀਂ ਪਿਆ ਹੈਗਾ ਬਾਹਰ ਜਾਣ ਦੇ ਆਪਾਂ ਨੂੰ ਕੋਈ ਫ਼ਾਇਦਾ ਨਹੀਂ ਹੈਗਾ ਜਿੰਨਾ ਫ਼ਾਇਦਾ ਆਪਾਂ ਨੂੰ ਇੱਥੇ ਆ ਆਪਾਂ ਨੂੰ ਪੰਜਾਬ ਵਿੱਚ ਰਹਿ ਕੇ ਹੀ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਪਰ ਅੱਜ ਕੱਲ੍ਹ ਦੇ ਬੱਚੇ ਇਹ ਗੱਲ ਕਿੱਥੋਂ ਸਮਝਦੇ ਹਨ ਠੀਕ ਹੈ ਉਹ ਸਿਰਫ਼ ਇਹ ਜਾਣਦੇ ਹਨ ਕਿ ਉਹ ਬਾਹਰ ਜਾਣ ਅਤੇ ਵਧੀਆ ਆਪਣੇ ਪੈਸੇ ਕਮਾਉਣ ਮੇਨ ਗੱਲ ਇਹ ਹੈ ਕਿ ਉੱਥੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹ ਵਿਦੇਸ਼ ਜਾਂਦੇ ਹਨ ਪਹਿਲੀ ਗੱਲ ਤਾਂ ਉਹਨਾਂ ਨੂੰ ਭਾਸ਼ਾ ਦੀ ਰੁਕਾਵਟ ਆਉਂਦੀ ਹੈ ਦੂਜਾ ਸੱਭਿਆਚਾਰਕ ਅੰਤਰ ਹੁੰਦਾ ਹੈ ਤੀਜਾ ਉਹ ਹਮਦੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹੋ ਜਾਂਦੇ ਹਨ ਚੌਥਾ ਉਹ ਕਾਨੂੰਨੀ ਅਤੇ ਪ੍ਰਸ਼ਾਸ਼ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਰ ਉਹਨਾਂ ਨੂੰ ਰੁਜ਼ਗਾਰ ਦੀ ਅਸਥਿਰਤਾ ਆਉਂਦੀ ਹੈ ਉਹਨਾਂ ਨੂੰ ਜਾਂਦੇ ਸਾਰ ਨਹੀਂ ਕੰਮ ਲੱਭ ਜਾਂਦਾ ਉਹਨਾਂ ਨੂੰ ਬਹੁਤ ਜ਼ਿਆਦਾ ਭਕਾਈ ਕਰਨੀ ਪੈਂਦੀ ਹੈ ਫਿਰ ਕਿਤੇ ਜਾ ਕੇ ਉਹਨਾਂ ਨੂੰ ਕੰਮ ਲੱਭਦਾ ਹੈ ਫਿਰ ਉਹਨਾਂ ਨੂੰ ਮਨੋਵਿਗਿਆਨਿਕ ਮਸਲੇ ਦਾ ਸਾਹਮਣਾ ਕਰਨਾ ਪੈਂਦਾ ਹੈ ਵਿੱਤੀ ਸਮੱਸਿਆਵਾਂ ਆਉਂਦੀਆਂ ਹਨ ਪਹਿਲਾਂ ਤਾਂ ਮਾਂ ਪਿਓ ਕਰਜ਼ਾ ਲੈ ਕੇ ਵੀਹ ਤੀਹ ਲੱਖ ਰੁਪਏ ਦਾ ਆਪਣੇ ਬੱਚਿਆਂ ਨੂੰ ਭੇਜਦੇ ਹਨ ਫਿਰ ਉਹ ਆਪਣੇ ਹਾਂ ਫਿਰ ਉਹ ਉੱਥੇ ਜਾ ਕੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਉਹ ਆਪਣੇ ਮਾਂ ਪਿਓ ਤੋਂ ਹੀ ਪੈਸਿਆਂ ਦੀ ਡਿਮਾਂਡ ਕਰਦੇ ਹਨ ਕਿ ਉਹਨਾਂ ਨੂੰ ਹੋਰ ਪੈਸੇ ਦਿੱਤੇ ਜਾਣ ਤਾਂ ਕਰਕੇ ਮੇਰਾ ਇਹ ਹੀ ਹੈ ਕਿ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ ਅਤੇ ਇੱਥੇ ਹੀ ਰੱਖੋ